ਚੰਡੀਗੜ੍ਹ ਬੂਟੀਕ ਯੂਟਿਊਬ ਚੈਨਲ ਮੇਰਾ ਮਨਪਸੰਦ ਯੂਟਿਊਬ ਚੈਨਲ ਹੈ ਇਸ ਚੈਨਲ ਤੋਂ ਮੈਂ ਪੂਰੀ ਸਿਲਾਈ ਦਾ ਕੋਰਸ ਕੀਤਾ ਹੈ ਇਸ ਚੈਨਲ ਦੇ ਜ਼ਰੀਏ ਹੀ ਮੈਂ ਸਿਲਾਈ ਦਾ ਕੰਮ ਸਿੱਖਿਆ ਹੈ ਅਤੇ ਹਾਂ ਅੱਜ ਮੈਂ ਉਸ ਦੇ ਜ਼ ਉਸ ਚੈਨਲ ਤੋਂ ਕਿੰਨੇ ਹੀ ਡਿਜ਼ਾਈਨਸ ਨਵੇਂ ਨਵੇਂ ਸੂਟ ਬਣਾਉਣ ਦੇ ਸਿੱਖੇ ਹਨ ਅਤੇ ਅੱਜ ਮੈਂ ਉਸ ਚੈਨਲ ਨੂੰ ਦੇਖ ਕੇ ਹੀ ਆਪਣਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ ਇਸ ਚੈਨਲ ਦੇ ਜ਼ਰੀਏ ਮੈਂ ਨਵੇਂ ਨਵੇਂ ਸੂਟਾਂ ਦੇ ਡਿਜ਼ਾਈਨ ਸ਼ ਹੋਰ ਅਤੇ ਕਢਾਈ ਦੇ ਕਈ ਡਿਜ਼ਾਈਨ ਸਿੱਖੇ ਹਨ ਸਿਲਾਈ ਦੇ ਵਿੱਚ ਗਲੇ ਬਣ ਗਲੇ ਦੇ ਡਿਜ਼ਾਈਨ ਪਲੌਈਆਂ ਪਾਉਣੀਆਂ ਗੁੰਮ ਪਾਈਪੀਨ ਲਗਾਉਣੀ ਇਸ ਯੂਜ਼ਟਿਊਬ ਚੈਨਲ ਦੇ ਜ਼ਰੀਏ ਹੀ ਮੈਂ ਸਿੱਖਿਆ ਹੈ ਇਹ ਯੂਟਿਊਬ ਇੱਕ ਅਜਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਸਿਲਾਈ ਦੇ ਚੈਨਲ ਬਣੇ ਹੋਏ ਹਨ ਇਨ੍ਹਾਂ ਚੈਨਲਾਂ ਦੀ ਮਦਦ ਦੇ ਨਾਲ ਹੀ ਮੈਂ ਆਪਣਾ ਅੱਜ ਸਿਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਅੱਜ ਮੈਂ ਆਪਣਾ ਬੂਟੀਕ ਦਾ ਕੰਮ ਸ਼ੁਰੂ ਕਰ ਲਿਆ ਹੈ ਜਿਸ ਤੋਂ ਕਿ ਮੈਂ ਬੰਦ ਜਣਿਆ ਅਹ ਕਿੰਨੇ ਜਣਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ